ਦਸ ਫਰਵਰੀ ਉੱਨੀ ਸੌ ਚੁਰਾਸੀ ਅੱਠ ਜਨਵਰੀ ਦੋ ਹਜ਼ਾਰ ਗਿਆਰ੍ਹਾਂ ਸੱਤ ਅਪ੍ਰੈਲ ਉੱਨੀ ਸੌ ਚੁਰਾਸੀ ਤੇਈ ਅਗਸਤ ਦੋ ਹਜ਼ਾਰ ਚੌਦ੍ਹਾਂ ਉੱਨੀ ਅਕਤੂਬਰ ਉੱਨੀ ਸੌ ਪਚਾਸੀ